ਹਾਂ ਮੈਂ ਰੇਲ ਗੱਡੀ ਦਾ ਵਰਣਨ ਕਰ ਸਕਦਾ ਹਾਂ ਰੇਲ ਗੱਡੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਦਾ ਇੱਕ ਤਰ੍ਹਾਂ ਦਾ ਸਾਧਨ ਹੈ ਜਿਸ ਵਿੱਚ ਮਨੁੱਖ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਲਈ ਸਫ਼ਰ ਕਰਦੇ ਹਨ ਕੁਝ ਰੇਲ ਗੱਡੀਆਂ ਨੂੰ ਮਾਲ ਗੱਡੀ ਕਿਹਾ ਜਾਂਦਾ ਹੈ ਜਿਸ ਵਿੱਚ ਅਸੀਂ ਸਮਾਨ ਨੂੰ ਇੱਧਰ ਤੋਂ ਉੱਧਰ ਲੈ ਕੇ ਜਾਂਦੇ ਹਨ ਰੇਲ ਗੱਡੀ ਵੀ ਰੇਲ ਗੱਡੀ ਕਾਫ਼ੀ ਲੰਬੀ ਹੁੰਦੀ ਹੈ ਇਸ ਵਿੱਚ ਕਈ ਸੀਟਾਂ ਹੁੰਦੀਆਂ ਹਨ ਕਈ ਇਸ ਇਸ ਦੇ ਟਾਇਰ ਕਾਫ਼ੀ ਵੱਡੇ ਵੱਡੇ ਹੁੰਦੇ ਹਨ ਸੀਟਾਂ ਇਸ ਵਿੱਚ ਕਾਫ਼ੀ ਸਾਰੀ ਸੀਟਾਂ ਹੁੰਦੀਆਂ ਹਨ ਇਸ ਵਿੱਚ ਲਗਭਗ ਪੰਜ ਸੌ ਤੋਂ ਵੱਧ ਬੰਦੇ ਇੱਕ ਇੱਕ ਵਾਰ ਵਿੱਚ ਸਫ਼ਰ ਕਰ ਸਕਦੇ ਹਨ ਇਹ ਸਫ਼ਰ ਕਰਨ ਵਾਲੇ ਜਾਂ ਤਾਂ ਫਿਰ ਜੇ ਉਹਨਾਂ ਨੇ ਜ਼ਿਆਦਾ ਦੂਰ ਜਾਣਾ ਹੋਵੇ ਤਾਂ ਕਈ ਵਾਰ ਰੇਲ ਗੱਡੀ ਵਿੱਚ ਬੈੱਡ ਵੀ ਲੱਗੇ ਹੁੰਦੇ ਹਨ ਇਸ ਰੇਲ ਗੱਡੀ ਦੇ ਦੋ ਇੰਜਣ ਹੁੰਦੇ ਹਨ ਇੱਕ ਅੱਗੇ ਹੁੰਦਾ ਹੈ ਅਤੇ ਇੱਕ ਪਿੱਛੇ ਹੁੰਦਾ ਹੈ ਜਿਸ ਨਾਲ ਰੇਲ ਗੱਡੀ ਨੂੰ ਮੁੜਨਾ ਨਾ ਪਵੇ ਤਾਂ ਜੋ ਅੱਗੇ ਵਾਲਾ ਇੰਜਨ ਅੱਗੇ ਨੂੰ ਖਿੱਚਦਾ ਹੈ ਅਤੇ ਪਿੱਛੇ ਵਾਲਾ ਪਿੱਛੇ ਨੂੰ ਖਿੱਚਦਾ ਹੈ ਜਦੋਂ ਰੇਲ ਗੱਡੀ ਚੱਲਦੀ ਹੈ ਤਾਂ ਬਹੁਤ ਸ਼ੋਰ ਹੁੰਦਾ ਹੈ ਰੇਲ ਗੱਡੀ ਦੇ ਸ਼ੋਰ ਨਾਲ ਕਾਫ਼ੀ ਜ਼ਿਆਦਾ ਏਅਰ ਵੋਇਸ ਪੋਲਿਊਸ਼ਨ ਹੁੰਦਾ ਹੈ ਪਹੀਏ ਇਸਦੇ ਕਾਫ਼ੀ ਵੱਡੇ ਵੱਡੇ ਲੋਹੇ ਦੇ ਪਹੀਏ ਹੁੰਦੇ ਹਨ ਰੇਲ ਗੱਡੀ ਬਸ ਆਪਣੇ ਹੀ ਟਰੈਕ 'ਤੇ ਚੱਲਦੀ ਹੈ ਜੇਕਰ ਕੋਈ ਹੋਰ ਰੇਲ ਗੱਡੀ ਆ ਜਾਵੇ ਤਾਂ ਇਸ ਨੂੰ ਟਰੈਕ ਚੇਂਜ ਕਰਨਾ ਪੈਂਦਾ ਹੈ ਅਸੀਂ ਰੇਲ ਗੱਡ ਮੈਂ ਰੇਲ ਗੱਡੀ ਰਾਹੀਂ ਬਹੁਤ ਸਾਰੇ ਸਫ਼ਰ ਕੀਤੇ ਹਨ ਜਿਵੇਂ ਕਿ ਮੈਂ ਹੁਣ ਤੱਕ ਰੇਲ ਗੱਡੀ ਨਾਲ਼ ਅੰਬਾਲੇ ਵੀ ਗਿਆ ਹਾਂ ਅਤੇ ਅੰਮ੍ਰਿਤਸਰ ਤੱਕ ਵੀ ਜਾ ਆਇਆ ਹਾਂ ਆਮ ਤੌਰ 'ਤੇ ਅਸੀਂ ਅਨੰਦਪੁਰ ਜਾਣ ਵਾਲੀ ਟਰੇਨ ਰਾਹ ਰਾਹੀਂ ਹਰ ਵਾਰ ਅਨੰਦਪੁਰ ਜਾਂਦੇ ਹਨ